ਹਾਂਜੀ ਹਾਂਜੀ ਹਾਂਜੀ ਹਾਂਜੀ ਮੈਂ ਫਾਰਮਰ ਗੱਲ ਕਰ ਰਿਹਾ ਜੀ

ਹਰ ਤਰਹਾਂ ਦਾ ਚਾਵਲ ਹਰ ਤਰਹਾਂ ਦਾ ਚਾਵਲ ਬਾਸਮਤੀ ਤੋਂ ਲੈ ਕੇ ਹਰ ਇਕ ਪ੍ਰਕਾਰ ਦਾ ਚਾਵਲ ਉਗਾਨੇ ਆ ਅਸੀਂ ਕਟਾਈ ਦਾ ਸ਼ੁਰੂ ਹੋ ਗਿਆ ਜੀ ਬੀਜਾ ਬੀਜਣ ਦਾ ਟਾਈਮ ਤਾਂ ਹਾਂ ਗਰਮੀਆਂ ਚ ਆ ਜਾਂਦਾ ਨਾ ਤੇ ਹੁਣ ਤਾਂ ਕਟਾਈ ਦਾ ਟਾਈਮ ਚੱਲ ਰਿਹਾ ਇਸ ਤੋਂ ਬਾਅਦ ਕੀ ਹੁਣ ਸਾਗ ਦਾ ਜਿਦਾਂ ਮੇਥੀ ਦਾ ਸਾਗ ਪਾਲਕ ਦਾ ਇਸ ਤੋਂ ਬਾਅਦ ਹੁਣ ਬੀਜਾਂਗੇ ਔਰ ਉਸ ਤੋਂ ਦੋ ਮਹੀਨੇ ਬਾਅਦ ਉਸ ਤੋਂ ਬਾਅਦ ਉਸ ਤੋਂ ਬਾਅਦ ਕਣਕ ਦਾ ਸੀ ਕਣਕ ਕਣਕ ਬੀਜਾਂਗੇ ਹਾਂਜੀ ਬਸ ਇਸ ਤੋਂ ਬਾਅਦ ਜੀ ਪੱਠੇ ਪੱਠੇ ਬੀਜਾਂਗੇ ਪੱਠਿਆਂ ਪੱਠੇ ਦਾ ਮਹੀਨੇ ਹਾਂਜੀ ਹਾਂਜੀ ਪਸ਼ੂ ਵਾਸਤੇ ਪੱਠੇ ਪੱਠੇ ਵਗੈਰਾ ਬੀਜਣਗੇ ਬੀਜਾਂਗੇ ਔਰ ਉਸ ਤੋਂ ਬਾਅਦ ਕਣਕ ਦਾ ਸੀਜਨ ਕਣਕ ਦਾ ਸ਼ੁਰੂ ਕਰਾਂਗੇ ਤੜਕ ਬੀਜਾਂਗੇ ਔਰ ਜਿਹੜਾ ਕਿ ਅਪ੍ਰੈਲ ਦੇ ਵਿੱਚ ਜਾ ਕੇ ਕਣਕ ਦੀ ਵਡਿਆਈ ਸ਼ੁਰੂ ਹੋਏਗੀ ਹੋਰ ਹੋਰ ਜੀ ਇਸ ਤੋਂ ਇਲਾਵਾ ਸ਼ਿਮਲਾ ਮਿਰਚ ਮੂਲੀ ਗੋਬੀ ਹਾਂ ਹਾਂਜੀ ਏ ਰੁਤ ਦੇ ਹਿਸਾਬ ਨਾਲ ਵੀਕਦੇ ਆ ਹਾਂ ਹੋਰ ਤਾਂ ਜੀ ਫਿਲਹਾਲ ਸਰਦੀਆਂ ਦਾ ਮੌਸਮ ਹੈ ਹੁਣ ਗੰਨੇ ਦਾ ਸੀਗਾ ਗੰਨਾ ਵੀ ਬੀਜਾਂਗੇ ਹਾਂਜੀ ਹਾਂਜੀ ਹਾਂਜੀ ਇਸ ਤੋਂ ਪਹਿਲਾਂ ਇਸ ਤੋਂ ਪਹਿਲਾਂ ਗੰਨੇ ਦਾ ਉਸ ਤੋਂ ਬਾਅਦ ਕਣਕ ਦਾ ਸ਼ੁਰੂ ਕਰਾਂਗੇ ਹਾਂਜੀ ਹਾਂਜੀ ਹਾਂਜੀ ਇਹਨਾਂ ਸੀਜਨ ਪੀ ਇਹਨਾਂ ਦਾ ਪੱਠੇ ਗੰਨਾ ਔਰ ਜਿੱਦਾਂ ਸਾਗ ਮਲਕ ਹੋ ਗਈ ਹਰੀ ਸਬਜੀਆਂ ਹੋ ਗਈਆਂ ਵੇਖੀ ਹੋ ਗਈ ਇਹ ਇਨਾ ਇਨਾ ਸਰਦੀਆਂ ਦੇ ਸੀਜ਼ਨ ਦੇ ਵਿੱਚ ਇਹ ਗਾਵਾਂਗੇ ਇਹਨਾਂ ਦੇ ਇਹਨਾਂ ਦੀ ਵਾਈ ਕਰਾਂਗੇ ਹਾਂਜੀ ਹਾਂਜੀ ਹੋਰ ਹੋਰ ਤਾਂ ਹੋਰ ਤਾਂ ਇਸ ਤੋਂ ਇਲਾਵਾ ਬਸ ਫਾਰਮਰ ਆ ਮੈਂ ਕਿਸਾਨ ਔਰ ਇਸ ਤੋਂ ਇਲਾਵਾ ਕੰਮ ਨਹੀਂ ਕਰਦਾ ਮੈਂ ਹਾਂਜੀ ਹਾਂਜੀ ਹਾਂਜੀ ਗੰਨੇ ਹੋਰ ਗਰਮੀਆਂ ਦੇ ਵਿੱਚ ਕਣਕ ਦਾ ਅਸੀਂ ਸ਼ੋ ਹੋ ਜਾਂਦਾ ਕਣਕ ਬੀਜਦੇ ਆ ਪਹਿਲਾਂ ਕ ਹਾਂਜੀ ਹਾਂਜੀ ਕਣਕ ਦਾ ਸੀਜ਼ਨ ਸ਼ੁਰੂ ਹੋ ਜਾਏਗਾ ਫਿਰ ਕਣਕ ਬੀਜਾਂਗੇ ਔਰ ਗਰਮੀਆਂ ਦੀ ਸਬਜ਼ੀ ਵਾਲੇ ਜੀ ਜਿਦਾਂ ਕਹਿ ਸਕਦੇ ਆ ਆਪਾਂ ਹਾਂ ਠੰਡੀ ਸ ਹਾਂਜੀ ਹਾਂਜੀ ਇਹ ਗਰਮੀਆਂ ਚ ਇਹ ਗਰਮੀਆਂ ਦਾ ਹੀ ਕੰਮ ਗਰਮੀਆਂ ਦੇ ਨਾਲ ਕੰਮ ਗਰਮੀਆਂ ਚਦੇ ਹੋ ਗਏ ਕੱਦੂ ਹੋ ਗਿਆ ਹਾਂਜੀ ਹਾਂਜੀ ਇਹ ਹਾਂਜੀ ਇਹ ਗਰਮੀਆਂ ਚ ਬੀਜਦੇ ਆ ਹਾਂਜੀ ਹਾਂਜੀ ਇਹ ਗਰਮੀਆਂ ਚ ਇਹ ਗਰਮੀਆਂ ਚ ਬੀਜਦੇ ਆ ਹਾਂਜੀ ਹਾਂਜੀ ਕਣਕ ਦੇ ਚੀਨ ਤੋਂ ਬਾਅਦ ਇਹ ਸ਼ੁਰੂ ਹੋ ਜਾਂਦਾ ਫਿਰ ਕੰਡੇ ਜਿੱਦਾਂ ਹੋ ਗਿਆ ਤੁਹਾਡੀ ਹੋ ਗਈ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਠੀਕ ਹ